ਨਹੀਂ ਮੈਨੂੰ ਨਈ ਲੱਗਦਾ ਵੀ ਪ੍ਰਿਥਵੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ 'ਤੇ ਜੀਵਨ ਦੀ ਆਸ ਕਰਨੀ ਚਾਹੀਦੀ ਹੈ ਅੱਜ ਤੱਕ ਦੇ ਵਿਗਿਆਨੀਆਂ ਦੀਆਂ ਖੋਜਾਂ ਵਿੱਚ ਕਿਸੇ ਵੀ ਗ੍ਰਹਿ 'ਤੇ ਜੀਵਨ ਦੀ ਖੋਜ ਨਹੀਂ ਹੋਈ ਕਿਉਂਕਿ ਵਿਗਿਆਨੀਆਂ ਨੇ ਕਾਫੀ ਗ੍ਰਹਿ ਜਿਵੇਂ ਮ ਮੰਗਲ ਗ੍ਰਹਿ ਬ੍ਰਹਿਸਪਤੀ ਗ੍ਰਹਿ ਸ਼ੁੱਕਰ ਗ੍ਰਹਿ ਆਦਿ 'ਤੇ ਜੀਵਨ ਦੀ ਖੋਜ ਕਰਨੀ ਚਾਹੀ ਪਰ ਉਹਨਾਂ ਨੂੰ ਕੁਛ ਨਾ ਹਾਸਿਲ ਨਹੀਂ ਹੋਇਆ ਜਿਵੇਂ ਉਦਾਹਰਨ ਵਜੋਂ ਮੰਗਲ ਗ੍ਰਹਿ ਮੰਗਲ ਗ੍ਰਹਿ 'ਤੇ ਸੀ ਓ ਟੂ ਦੀ ਮਾਤਰਾ ਬਹੁਤ ਜ਼ਿਆਦਾ ਹੈ ਜੋ ਕਿ ਮਨੁੱਖ ਦੀ ਸਿਹਤ ਲਈ ਹਾਨੀਕਾਰਕ ਹੈ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਮੀਥੇਨ ਨਾਈਟਰੇਟ ਆਦਿ ਦੀ ਮਾਤਰਾ ਵੀ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਉੱਥੇ ਆਕਸੀਜਨ ਪਾਣੀ ਹਵਾ ਆਦਿ ਦੀ ਮਾਤਰਾ ਨਹੀਂ ਹੈ ਜੇਕਰ ਸਾਨੂੰ ਮੰਗਲ ਗ੍ਰਹਿ 'ਤੇ ਜੀਵਨ ਦੀ ਆਸ ਕਰਨੀ ਹੈ ਤਾਂ ਸਾਨੂੰ ਪ੍ਰਿਥਵੀ ਤੋਂ ਹੀ ਆਕਸੀਜਨ ਪਾਣੀ ਅਤੇ ਹਵਾ ਆਦਿ ਨਾਲ ਲੈ ਕੇ ਜਾਣਾ ਪਵੇਗਾ ਇਸ ਤੋਂ ਇਲਾਵਾ